ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਵਧੀਆ ਭਾਅ ਜੀ ਤੁਸੀਂ ਕੌਣ ਹਾਂ ਹਾਂਜੀ ਭਾਅ ਜੀ ਅੱਛਾ ਅੱਛਾ ਅੱਛਾ ਅੱਛਾ ਇੱਕ ਚਾਰ ਨਮ ਨਵੇਂ ਆਏ ਭਾਅ ਜੀ

ਹਾਂਜੀ ਹਾਂਜੀ ਹਾਂਜੀ ਨਾ ਨਾ ਕੋਈ ਨਹੀਂ ਭਾਅ ਜੀ ਯਾਰ ਦੱਸੋ ਕੋਈ ਹੂੰ ਹਾਂਜੀ ਹਾਂਜੀ ਹਾਂਜੀ

ਹਾ ਹਾ ਹਾਂਜੀ ਹਾਂਜੀ ਐ ਮੈਂ ਨਾ ਤੁਹਾਨੂੰ ਦੱਸਦਾ ਭਾਅ ਜੀ ਯਾਰ ਇੱਥੇ ਵਧੀਆ ਸਬਜ਼ੀ ਨਾ ਉੱਥੇ ਮਿਲਦੀ ਭਾਅ ਜੀ ਜਿਹੜਾ ਜਿਹੜਾ ਇਹ ਰੇਲਵੇ ਸਟੇਸ਼ਨ ਹੈਗਾ ਇੱਥੇ ਕਪੂਰਥਲਾ ਉਹ ਤੋਂ ਅੱਗੇ ਨੂੰ ਜਾ ਕੇ ਨਾ ਸੌ ਦੋ ਸੌ ਮੀਟਰ ਅੱਗੇ ਜਾ ਕੇ ਨਾ ਇੱਕ ਬਾਬਾ ਬਹਿੰਦਾ ਉਹ ਹਾਂ ਉਹ ਔਰਗੈਨਿਕ ਸਬਜ਼ੀਆਂ ਦਿੰਦਾ ਇੱਥੇ ਆਪਣੀਆਂ ਘਰ ਦੀਆਂ ਲਾਈਆਂ ਵੀਆਂ ਪਰ ਉਹਦਾ ਰੇਟ ਤਾਂ ਪਰ ਜ਼ਿਆਦਾ ਹੁੰਦਾ ਹੈ ਸਬਜ਼ੀ ਦਾ ਪਰ ਐਨ ਬਿਮਾਰੀ ਫ੍ਰੀ ਕੋਈ ਉਹਦੇ 'ਚ ਕੀੜਾ ਮਕੋੜਾ ਨਹੀਂ ਕੁਝ ਨਹੀਂ ਹੈਗਾ ਐਨ ਦਵਾਈਆਂ ਵੀ ਫਰੀ ਐਨ ਵਧੀਆ ਔਰਗੈਨਿਕ ਘਰ ਦੀ ਸਬਜ਼ੀ ਵੇਚਦਾ ਐਨ ਇੰਨੀ ਵਧੀਆ ਸਬਜ਼ੀ ਹੁੰਦੀ ਖਾ ਕੇ ਯਾਰ ਬੰਦਾ ਅਨੰਦ ਆ ਜਾਂਦਾ ਉਹਦੀ ਸਬਜ਼ੀ ਐਨੀ ਘੈਂਟ ਹੁੰਦੀ ਹੈ ਤੁਸੀਂ ਕਹੋਗੇ ਯਾਰ ਸ਼ਹਿਰ 'ਚ ਵੀ ਮੰਡੀ 'ਚ ਵੀ ਸਬਜ਼ੀ ਐਨ ਟੀਕਿਆਂ ਵਾਲੀ ਆਉਂਦੀ ਬਿਮਾਰੀਆਂ ਵਾਲੀ ਸਬਜ਼ੀ ਆ ਉਹਨਾਂ ਨਾਲੋਂ ਤੁਸੀਂ ਨਾ ਭਾਅ ਜੀ ਉਹ ਵਾ ਹੈ ਨਾ ਹਾਂ ਉਹ ਤਾਂ ਹੀ ਹੋ ਗਈ ਭਾਅ ਜੀ ਉਹ ਬਿਮਾਰੀਆਂ ਵਾਲੀ ਟੀਕਿਆਂ ਵਾਲੀ ਸਬਜ਼ੀ ਸੀ ਇਸ ਲਈ ਉਹ ਟਿਕੀ ਨਹੀਂ ਜ਼ਿਆਦਾ ਇਸ ਲਈ ਤੁਹਾਨੂੰ ਕਹਿੰਦਾ ਉਹ ਜਾਂ ਇੱਕ ਉਹ ਬਾਬਾ ਜਾਂ ਫਿਰ ਭਾਅ ਜੀ ਇੱਧਰ ਬੈਠਦਾ ਉਹ ਏ ਕਪੂਰਥਲੇ ਬਾਈਪਾਸ 'ਤੇ ਇੱਕ ਅੰਕਲ ਬੈਠਦਾ ਉਹਨੂੰ ਉਹ ਵੀ ਇੱਦਾਂ ਦੀ ਸਬਜ਼ੀ ਦਿੰਦਾ ਉਹ ਵੀ ਉਹਦੇ ਵੀ ਰੇਟ ਪਰ ਠੀਕ ਹੈ ਪਰ ਐਂ ਹੈ ਪਰ ਉਹਨੇ ਬਾ ਉਹਨੇ ਨਾ ਔਰਗੈਨਿਕ ਸਬਜ਼ੀਆਂ ਉਹਨਾਂ ਦੀਆਂ ਦਵਾਈ ਫਰੀ ਮੁਫ਼ਤ ਐਨ ਉਹਨਾਂ 'ਚ ਦਵਾਈਆਂ ਉਹਨੇ ਉਹਨਾਂ ਕੀੜਾ ਫਰੀ ਐਨ ਵਧੀਆ ਪਰ ਅੰਕਲ ਉਹ ਬੰਦਾ ਉਹ ਤੁਹਾਨੂੰ ਨੇੜੇ ਪੈਣਾ ਭਾਅ ਜੀ ਯਾਰ ਇਹ ਆਹ ਬਾਈਪਾਸ ਵਾਲਾ ਕੋਈ ਨਹੀਂ ਭਾਅ ਜੀ ਹਾਂ ਉਹ ਤਾਂ ਉਹ ਤਾਂ ਹੈ ਹਾਂ ਹਾਂਜੀ ਹਾਂਜੀ ਉਹ ਉੱਥੇ ਹਾਂ ਉਹ ਹੀ ਉਹ ਹੀ ਕਹਿੰਦਾ ਭਾਅ ਜੀ ਉੱਥੇ ਤੁਹਾਨੂੰ ਸਬਜ਼ੀ ਵਧੀਆ ਮਿਲ ਜਾਣੀ ਅਤੇ ਉੱਥੇ ਦਵਾਈ ਫਰੀ ਮੁਫ਼ਤ ਤੁਸੀਂ ਉੱਥੇ ਜਾ ਕੇ ਨਾ ਉਹ ਬਾਬੇ ਬਾਬੇ ਉਹ ਦਾ ਰੇਟ ਪਰ ਜਾ ਹਾਈ ਹੋਣਾ ਪਰ ਉਹਦੀ ਚੀਜ਼ ਵਧੀਆ ਹੁੰਦੀ ਹੈ ਉਹਦੇ ਕੋਲੋਂ ਕੋਈ ਨਹੀਂ ਭਾਅ ਜੀ ਸ਼ਾਮ ਨੂੰ ਤਾਂ ਮੈਂ ਫਰੀ ਨਹੀਂ ਹੈਗਾ ਤੁਸੀਂ ਜਾ ਆਇਓ ਭਾਅ ਜੀ ਤੁਹਾਨੂੰ ਤਾਂ ਦੱਸ ਤਾ ਉੱਥੇ ਉੱਥੇ ਹੈਗੀ ਸਬਜ਼ੀ ਉੱਥੇ ਤੁਹਾਨੂੰ ਮਿਲ ਜਾਣੀ ਹੈ ਐਨ ਵਧੀਆ ਦੋਵੇਂ ਬਾਬੇ ਸਭ ਤੋਂ ਵਧੀਆ ਸਬਜ਼ੀ ਦਿੰਦੇ ਠੀਕ ਹੈ ਭਾਅ ਜੀ ਤੁਹਾਨੂੰ ਦੱਸਦਾ ਹੈ ਨਾ ਅਤੇ ਇੱਥੇ ਦੇਖ ਲਿਓ ਹੈ ਨਾ ਭਾਅ ਜੀ ਹੋਰ ਕੋਈ ਤੇ ਕੰਮ ਹੋਇਆ ਤਾਂ ਜ਼ਰੂਰ ਦੱਸਿਓ ਠੀਕ ਹੈ ਭਾਅ ਜੀ ਓਕੇ ਓਕੇ ਭਾ ਸਤਿ ਸ਼੍ਰੀ ਅਕਾਲ ਭਾਅ ਜੀ